ਸਾਨੂੰ ਲੱਗਦਾ ਹੈ ਕਿ ਜੋ ਜੀਵਨ ਜੋ ਹੈ ਉਹ ਪ੍ਰਿਥਵੀ ਦੇ ਨਾਲ ਨਾਲ ਮੰਗਲ ਗ੍ਰਹਿ 'ਤੇ ਜੋ ਹੈ ਉਹ ਜੀਵਨ ਜੋ ਹੈ ਉਹ ਜੀਅ ਸਕਦੇ ਹਾਂ ਉਸਦਾ ਕਾਰਨ ਇਹ ਹੈ ਕਿ ਉੱਥੇ ਵਾਯੂਮੰਡਲ ਦੇ ਨਾਲ ਨਾਲ ਬਰਫ ਵੀ ਅਵੇਲੇਬਲ ਹੁੰਦੀ ਹੈ ਦੂਸਰਾ ਕਾਰਨ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਜੋ ਜੀਵਨ ਉੱਥੇ ਸੰਭਵ ਹੈ ਉਸ ਗ੍ਰਹਿ 'ਤੇ ਸੰਭਵ ਹੈ ਜਿੱਥੇ ਨਾ ਜ਼ਿਆਦਾ ਗਰਮੀ ਹੋਵੇ ਅਤੇ ਨਾ ਹੀ ਜ਼ਿਆਦਾ ਠੰਡ ਹੋਵੇ ਜਿੱਥੇ ਪਾਣੀ ਜੋ ਹੈ ਥੋੜ੍ਹਾ ਥੋੜ੍ਹਾ ਅਵੇਲੇਬਲ ਹੋਵੇ ਜਿੱਥੇ ਪਾਣੀ ਅਵੇਲੇਬਲ ਹੋਏਗਾ ਉੱਥੇ ਜੀਵਨ ਜੋ ਹੈ ਉਹ ਜੀਣਾ ਜੋ ਹੈ ਉਹ ਸੌਖਾ ਹੁੰਦਾ ਹੈ ਕਿਉਂਕਿ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਜਿਹੜਾ ਜੀਵਨ ਹੈ ਉਹ ਪਾਣੀ ਤੋਂ ਬਿਨਾਂ ਆਪਾਂ ਜੀਵਤ ਨਹੀਂ ਰਹਿ ਸਕਦੇ ਅਤੇ ਪਾਣੀ ਜੋ ਹੈ ਇੱਕ ਆਪਣੇ ਜੀਣ ਦਾ ਸਾਧਨ ਹੈ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੱਥੇ ਉਹ ਜਗ੍ਹਾ ਜਿੱਥੇ ਤਾਪਮਾਨ ਨਾ ਜ਼ਿਆਦਾ ਘੱਟ ਹੋਵੇ ਅਤੇ ਨਾ ਜ਼ਿਆਦਾ ਵੱਧ ਹੋਵੇ ਉੱਥੇ ਜੋ ਹੈ ਉਹ ਜੀਵਨ ਸੰਭਵ ਹੈ